ਸਤਿ ਸ਼੍ਰੀ ਅਕਾਲ ਰਮਨ ਭਾਅ ਜੀ ਹੋਰ ਕੀ ਹਾਲ ਚਾਲ ਅੱਜ ਕੱਲ੍ਹ ਤੁਸੀਂ ਫੋਨ ਹੀ ਨਹੀਂ ਕਰਦੇ ਮੈਂ ਤੁਹਾਡੇ ਉਰੇ ਔਡ ਮੈਂ ਜਸਪਾਲ ਬੋਲਦਾ ਮੈਂ ਤੁਹਾਡੇ ਉਰੇ ਆਰਡਰ ਕੀਤਾ ਸੀ ਜੋ ਅੱਗੇ ਕਰਦਾ ਉਹੀ ਉਹ ਮੈਂ ਪੁੱਛਣਾ ਸੀ ਕੱਦ ਤੱਕ ਬਣ ਕੇ ਤਿਆਰ ਹੋਏਗਾ ਉਹ ਮੈਂ ਚੱਲ ਦੱਸ ਦਿੰਦਾ ਕਿ ਮੈਂ ਕਿਆ ਕਿਆ ਔਰਡਰ ਕੀਤੇ ਤੇ ਮੈਂ ਸਪਰਿੰਗ ਰੋਲ ਕਰੇ ਸੀ ਇੱਕ ਪਲੇਟ ਅਤੇ ਇੱਕ ਪਲੇਟ ਸ਼ਾਹੀ ਪਨੀਰ ਕਰਿਆ ਸੀ ਨਾਲ ਆਪਣੀ ਪੰਜ ਬਟਰ ਨਾਨ ਕਰੇ ਤੇ ਜੀ ਅਤੇ ਹੋਰ ਦੋ ਠੰਡੇ ਦੀ ਬੋਤਲਾਂ ਤੀਆਂ ਅੱਗੇ ਅੱਗੇ ਵਾਲਾ ਹੀ ਔਰਡਰ ਆ ਮੇਰਾ ਤੁਹਾਨੂੰ ਪਤਾ ਹੀ ਹੈ ਬਸ ਉਹੀ ਸੇਮ ਆਪਣਾ ਪੁਰਾਣੇ ਵਾਲੇ ਦੀ ਤਰ੍ਹਾਂ ਵਧੀਆ ਜਿਹਾ ਬਣਾ ਕੇ ਭੇਜ ਦਿਓ ਹੋ ਸਕੇ ਤਾਂ ਛੇਤੀ ਤੋਂ ਛੇਤੀ ਕਰ ਦਿਓ ਗਰਮਾਂ ਗਰਮ ਜਿਵੇਂ ਦਾ ਅੱਗੇ ਬਣਾ ਕੇ ਭੇਜਦੇ ਹੋ ਤੁਸੀਂ ਵਧੀਆ ਤੋਂ ਵਧੀਆ